ਹਾਂਜੀ ਮੈਨੂੰ ਤਾਂ ਆਪਣੇ ਹਮੇਸ਼ਾ ਆਪਣੇ ਸੂਟਾਂ ਦੀ ਇੱਛਾ ਰਹਿੰਦੀ ਹੈ ਜਿਵੇਂ ਮੈਂ ਕਿਵੇਂ ਸੂਟ ਹੋਰ ਲੈਣੇ ਹਨ ਜਵੈਲਰੀ ਲੈਣੀ ਆ ਦੁਪੱਟੇ ਲੈਣੇ ਆ ਹੈਵੀ ਹੈਵੀ ਸੂਟਾਂ ਨਾਲ ਦੀ ਜਵੈਲਰੀ ਲੈਣੀ ਆ ਲੈਸ ਲੈਣੀ ਆ ਮੋਤੀਆਂ ਵਾਲੀ ਲੈਸ ਲੈਣੀ ਆ ਪਲੇਨ ਲੈਸ ਲੈਣੀ ਆ ਹਰ ਚੀਜ਼ ਹੈ ਜਿੱਦਾਂ ਆਪਣੇ ਸੂਟ ਨਾਲ ਵੇਅਰ ਕਰਨੀ ਆ ਜਿਵੇਂ ਹੈਵੀ ਦੁਪੱਟਾ ਲੈ ਲਓ ਹਲਕਾ ਲੈ ਲਓ ਫੁਲਕਾਰੀ ਲੈ ਲਓ ਤਾਂ ਮੈਨੂੰ ਆਪਣੇ ਸੋ ਸੂਟ ਸੂਟਾਂ ਦੀ ਜ਼ਿਆਦਾ ਇੱਛਾ ਰਹਿੰਦੀ ਆ ਹਰ ਕੁਛ ਵੀ ਮੰਗਣ ਦਾ ਮੈਨੂੰ ਸਭ ਤੋਂ ਪਹਿਲਾਂ ਇਹ ਹੀ ਹੁੰਦਾ ਮੈਂ ਆਪਣਾ ਸੂਟ ਲੈ ਕੇ ਆਵਾਂ ਮੇਰੀ ਇਹ ਹੀ ਸਾਰੀ ਇੱਛਾ ਜ਼ਿਆਦਾ ਸੂਟਾਂ ਦੀ ਇੱਛਾ ਹੁੰਦੀ ਆ ਪੰਜਾਬੀ ਸੂਟ ਜ਼ਿਆਦਾ ਮੈਂ ਪੰਜਾਬੀ ਸੂਟ ਪਾਉਂਦੀ ਹਾਂ ਪੰਜਾਬੀ ਸੂਟ ਮੈਨੂੰ ਬਹੁਤ ਵਧੀਆ ਲੱਗਦੇ ਹਨ ਪਟਿਆਲਾ ਸਲਵਾਰ ਪੰਜਾਬੀ ਕੁੜਤਾ ਚੁੰਨੀ ਪੰਜਾਬੀ ਗੋਟਾ ਲਹਿੰਗਾ ਘੱਗਰੇ ਇਹ ਜ਼ਿਆਦਾ ਮੈਨੂੰ ਸੂਟਾਂ ਦਾ ਬਹੁਤ ਸ਼ੌਂਕ ਆ ਜਦੋਂ ਵੀ ਮੈਂ ਜਿਵੇਂ ਕਿ ਸੂਟ ਲੈ ਕੇ ਆਉਂਦੀ ਹਾਂ ਫਿਰ ਉਹ ਮੈਂ ਸੋਚਦੀ ਹਾਂ ਉਹਦੇ ਨਾਲ ਮੈਂ ਕਿੱਦਾਂ ਦੀ ਲੈਸ ਵੇਅਰ ਕਰਨੀ ਆ ਕਿੱਦਾਂ ਦਾ ਮੈਂ ਦੁ ਚੁਨੀ ਨਾਲ ਮੈਂ ਗੋਟਾ ਵੇਅਰ ਕਰਨਾ ਕਿਸ ਤਰ੍ਹਾਂ ਦੀ ਮੈਂ ਕਲਰ ਡਾਈ ਕਰਾਉਣਾ ਕਿਹੜਾ ਕਲਰ ਮੈਨੂੰ ਚਾਹੀਦਾ ਬਸ ਮੇਰੀ ਸਾਰੀਆਂ ਇੱਛਾ ਇਹ ਹੀ ਹੁੰਦੀਆਂ ਸੂਟ ਮੈਂ ਚੰਗੀ ਬਟੀਕ ਤੋਂ ਸਿਲਾਈ ਕਰਾਉਣਾ ਚੰਗਾ ਸੂਟ ਵਧੀਆ ਸਿਲਾ ਕਰਾ ਕੇ ਚੰਗੀ ਹਰ ਚੀਜ਼ ਜਵੈਲਰੀ ਨਾਲ ਦੀ ਮੈਚ ਕਰਕੇ ਮੈਨੂੰ ਸਾਰੇ ਸੂਟ ਹੁਣ ਕੋਈ ਮੈਨੂੰ ਸੂਟ ਬਾਰੇ ਸੂਟਾਂ ਬਾਰੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਿਵੇਂ ਕਿ ਮੈਂ ਹੁਣ ਮੈਂ ਮਸਟਰਡ ਸੂਟ ਪਸੰਦ ਕੀਤਾ ਮੈਨੂੰ ਉਹ ਜ਼ਿਆਦਾ ਵਧੀਆ ਲੱਗਦਾ ਉਹਦੇ ਨਾਲ ਦੀ ਹੀ ਮੈਂ ਨੀਚੇ ਮਸਟਰ ਕਰੇਵ ਸਿਲਕ ਦਾ ਔਰ ਮਸਟਰ ਸੀਸਾ ਸਿਲਕ ਦਾ ਉਹਦੇ ਨਾਲ ਮੈਂ ਟਾਫਟਾ ਲਵਾਉਣੇ ਮੈਨੂੰ ਪਸੰਦ ਆ ਵੀ ਮੈਂ ਫਿਰ ਮੈਂ ਇੱਕ ਹੋਰ ਕਲਰ ਪਸੰਦ ਕੀਤਾ ਫਿਰ ਮੈਨੂੰ ਉਹਦੇ ਨਾਲ ਮੈਂ ਡਾਈ ਕਰਾਉਣਾ ਦੇ ਕੇ ਆਈ ਹਾਂ ਉਹਦੇ ਨਾਲ ਵੀ ਮੈਨੂੰ ਚੰਗੇ ਚੰਗੇ ਭਾਰੇ ਭਾਰੇ ਹੈਵੀ ਹੈਵੀ ਦੁਪੱਟੇ ਸੋਹਣੇ ਲੱਗਦੇ ਆ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਜ਼ਿਆਦਾ ਆਪਣੇ ਮੇਰੀ ਇਹ ਹੀ ਇੱਛਾ ਕਿ ਮੈਂ ਵਧੀਆ ਸੂਟ ਪਾਵਾਂ ਕਿਸੇ ਦਾ ਇੱਕ ਸ਼ੌਂਕ ਹੁੰਦਾ ਆਪਣਾ ਚੰਗਾ ਸੂਟ ਪਾਓ ਚੰਗੇ ਦੁਪੱਟਾ ਲਓ ਪੰਜਾਬੀ ਵਿਰਸੇ ਦਾ ਸੂਟ ਹੋਵੇ ਸੋਹਣਾ ਹੈਵੀ ਹੋਵੇ ਲੌਂਗ ਸੂਟ ਸ਼ਲਟ ਹੋਵੇ ਸਲਵਾਰ ਭਾਰੀ ਹੋਵੇ ਮੈਨੂੰ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਸ਼ੌਂਕ ਆ ਆਪਣੇ ਸੂਟਾਂ ਨਾਲ ਜਦੋਂ ਵੀ ਮੈਂ ਵਧੀਆ ਸੂਟ ਪਾਉਣੇ ਅਤੇ ਮੈਨੂੰ ਆਪਣੇ ਮਨ ਨੂੰ ਖੁਸ਼ੀ ਮਿਲਦੀ ਆ ਇਹਦੇ ਕਰਕੇ ਫਿਰ ਮੈਨੂੰ ਜ਼ਿਆਦਾ ਸੂਟਾਂ ਦਾ ਸ਼ੌਂਕ ਆ ਥੈਂਕ ਯੂ ਧੰਨਵਾਦ